ਮੈਂ ਮਤਲਬ ਤਕਰੀਬਨ ਸਮੁੰਦਰ ਵੱਲ ਜਾਣਾ ਪਸੰਦ ਕਰਦਾ ਸਮੁੰਦਰ ਦੇ ਵਿੱਚ ਵਿੱਚ ਮਲ ਕਾਫੀ ਜਿੱਦਾਂ ਛੱਲਾਂ ਆਉਂਦੀਆਂ ਰੰਗ ਬਰੰਗਾਂ ਹੋਰ ਪਕਸ਼ੀ ਜੋ ਵੀ ਆ ਜੀਵ ਜੰਤੂ ਘੋਗੇ ਅਤੇ ਉੱਥੇ ਨਜ਼ਾਰਾ ਹੁੰਦਾ ਸਮੁੰਦਰ ਦੇ ਵਿੱਚ ਕਾਫੀ ਇਸ ਤੋਂ ਬਿਹਤਰੀ ਜਿਹੜੀ ਹੈ ਜਦੋਂ ਇਹ ਜਵਾਰਭਾਟੇ ਨਾਲ ਵੀ ਜੁੜਿਆ ਹੋਇਆ ਸਮੁੰਦਰ ਜਿਹੜਾ ਛੱਲਾਂ ਆਉਂਦੀਆਂ ਕਈ ਵਾਰੀ ਬਹੁਤ ਜ਼ਿਆਦਾ ਲਾਰਜ ਸਕੇਲ 'ਤੇ ਨੁਕਸਾਨ ਵੀ ਹੋ ਜਾਂਦਾ ਕਈ ਉੱਥੇ ਜਿਹੜੇ ਗਏ ਹੁੰਦੇ ਨੇ ਸੱਜੇ ਖੱਬੇ ਧੰਨਵਾਦ